ਭਾਅ ਜੀ ਕੀੜੀ ਦੀ ਚਾਲ ਚੱਲੀ ਜਾਂਦੀ ਯਾਰ ਗੱਡੀ ਕਦੋਂ ਤਾਈਂ ਪਹੁੰਚਣਗੇ ਅਸੀਂ ਸਮੇਂ 'ਤੇ ਪਹੁੰਚ ਜਾਵੇਗੀ ਕੈਬ ਇੱਥੇ ਤਾਂ ਬੜਾ ਜਾਮ ਲੱਗਿਆ ਪਿਆ ਯਾਰ ਕੀੜੀ ਦੀ ਚਾਲ ਚੱਲੀ ਜਾਂਦੀਆਂ ਗੱਡੀਆਂ ਲੱਗਦਾ ਕੋਈ ਵੀ ਆਈ ਪੀ ਨੇ ਆਉਣਾ ਤਾਂ ਕਰਕੇ ਜਾਮ ਲੱਗਿਆ ਵੈਸੇ ਇਸ ਏਰੀਆ 'ਚ ਲਾਈਟਾਂ ਵੀ ਬਹੁਤ ਹੈਗੀਆਂ ਤਾਂ ਕਰਕੇ ਵੀ ਜਾਮ ਲੱਗਿਆ ਹੋਵੇਗਾ ਭਾਅ ਜੀ ਮੇਰਾ ਤਾਂ ਅੱਜ ਇੱਕ ਇੰਟਰਵੂ ਹੈਗਾ ਮੈਨੂੰ ਛੇਤੀ ਪਹੁੰਚਣਾ ਹੈਗਾ ਕੋਈ ਹੋਰ ਤੇਜ਼ ਰਸਤਾ ਨਹੀਂ ਹੈਗਾ ਆਸੇ ਪਾਸੇ ਕਿਸੇ ਨੂੰ ਪੁੱਛ ਲਿਓ ਕੋਈ ਹੋਰ ਤੇਜ਼ ਰਸਤਾ ਹੈਗਾ ਗੂਗਲ ਮੈਪਸ 'ਚ ਤਾਂ ਵਿਖਾ ਰਿਹਾ ਉਹ ਭੀੜੀ ਗਲੀਆਂ ਹੈਗੀਆਂ ਉੱਧਰੋਂ ਗੱਡੀ ਲੱਗ ਜਾਣੀ ਆਪਣੀ ਤੁਸੀਂ ਇੱਦਾਂ ਕਰੋ ਜੀ ਰੈਡ ਰੈਡ ਲਾਈਟ ਤੋਂ ਸੱਜੇ ਹੋ ਕੇ ਫਿਰਨੀ ਵਾਲੇ ਰੋਡ ਤੋਂ ਛੱਡ ਦਿਓ ਸੌਖਾ ਹੋ ਜਾਵੇਗਾ ਭਾਅ ਜੀ ਮਾੜਾ ਜਿਹਾ ਛੇਤੀ ਕਰ ਲਓ ਯਾਰ ਇੰਟਰਵਿਊ ਹੈਗਾ ਮੇਰਾ ਮਾੜਾ ਜਿਹਾ ਛੇਤੀ ਕਰ ਲਿਓ